ਮੈਂ ਰਾਜ ਕੁਮਾਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਕੰਮ ਕਰਨ ਦਾ ਕਾਰੋਬਾਰ ਕਰਨ ਦਾ ਸੋਚਿਆ ਉਸ ਤੋਂ ਪਹਿਲਾਂ ਮੈਂ ਰਸਮੀ ਰਿਵਾਜ਼ਾਂ ਨਾਲ ਆਪਣੇ ਪੰਡਿਤ ਕੋਲ ਜਾ ਕੇ ਉਸਦਾ ਮੂਹਰਤ ਨਿਕਵਾਲਿਆ ਤਾਂ ਕੁਛ ਜ਼ਮੀਨ ਖਰੀਦ ਕੇ ਚਾਹੇ ਦੁਕਾਨ ਬਣਾ ਕੇ ਆਪਣੇ ਰੀਤੀ ਰਿਵਾਜ਼ਾਂ ਨਾਲ ਹਵਨ ਕਰਵਾ ਕੇ ਇੱਕ ਕੰਪਨੀ ਨਾਲ ਕਾਰੋਬਾਰ ਕਰਨ ਦਾ ਸੋਚਿਆ ਜਦੋਂ ਮੈਂ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਕੰਪਨੀ ਕਹਿੰਦੀ ਹੈ ਕਿ ਤੁਸੀਂ ਸ਼ੁਰੂਆਤ ਕਰੋ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਮੈਂ ਕੁਝ ਪੈਸੇ ਲਗਾ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਸ ਵਿੱਚ ਮੈਨੂੰ ਕਾਫੀ ਫਾਇਦਾ ਮਿਲਿਆ ਔਰ ਜੋ ਵੀ ਕੰਮ ਮੈਂ ਕੀਤਾ ਆਪਣੇ ਰੀਤੀ ਰਿਸ਼ਮਾ ਰਿਵਾਜ਼ਾਂ ਨਾਲ ਕੀਤਾ